ਪੰਜਾਬੀ ਭਾਸ਼ਾ ਦਾ ਜਿਹੜਾ ਹਾਲ ਆ ਉਹ ਹੁਣ ਮਾੜਾ ਹੀ ਆ ਜਿਵੇਂ ਹੁਣ ਬੱਚਿਆਂ ਨੂੰ ਜ਼ਿਆਦਾ ਤੌਰ 'ਤੇ ਇੰਗਲਿਸ਼ ਮੀਡੀਅਮ ਅਤੇ ਹਿੰਦੀ ਮੀਡੀਅਮ ਸਕੂਲਾਂ ਵਿੱਚ ਲਾਉਣ ਲੱਗ ਗਏ ਅਤੇ ਬਾਹਰ ਜਾਣ ਕਰਕੇ ਇੰਗਲਿਸ਼ ਨੂੰ ਜ਼ਿਆਦਾ ਹੀ ਪੜ੍ਹ ਰਹੇ ਨੇ ਅਤੇ ਸਰਕਾਰ ਵੀ ਪੰਜਾਬੀ ਨੂੰ ਘੱਟ ਬੱਚਿਆਂ ਨੂੰ ਟੀਚਰ ਰੱਖ ਰਹੇ ਨੇ ਪੜ੍ਹਾਉਣ ਤੋਂ ਉਹ ਕਰਦੇ ਨੇ ਵੀ ਜ਼ਿਆਦਾ ਤੌਰ 'ਤੇ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਸਕੂਲ ਵਿੱਚ ਹੀ ਲਾਇਆ ਜਾ ਰਿਹਾ ਅਤੇ ਹਿੰਦੀ ਮੀਡੀਅਮ ਸਕੂਲ ਵਿੱਚ ਬਾਹਰ ਜਾਣ ਕਰਕੇ ਇਹਨਾਂ ਨੂੰ ਜ਼ਿਆਦਾ ਹੀ ਇੰਗਲਿਸ਼ ਸਿਖਾਉਂਦੇ ਹਨ